ਹੈਲੋ ਹੈਲੋ ਦੀਪਾਲੀ ਸਤਿ ਸ਼੍ਰੀ ਅਕਾਲ ਮੈਂ ਠੀਕ ਹਾਂ ਅਤੇ ਆਸ਼ਾ ਕਰਦੀ ਹਾਂ ਤੁਸੀਂ ਵੀ ਠੀਕ ਹੋਵੋਗੇ ਬਸ ਠੀਕ ਅਤੇ ਅੱਜ ਕੱਲ੍ਹ ਜਿਹੜੀ ਨਵੀਂ ਫਿਲਮ ਆਈ ਹੈ ਉਸ ਬਾਰੇ ਹੀ ਚਰਚਾ ਚੱਲ ਰਹੀ ਸੀ ਹਾਂਜੀ ਅੱਜ ਕੱਲ੍ਹ ਤਾਂ ਪੰਜਾਬੀ ਕਲਾਕਾਰਾਂ ਨੇ ਵੀ ਬਹੁਤ ਨਾਮ ਕਮਾ ਲਿਆ ਹੈ ਪੰਜਾਬੀ ਫਿਲਮਾਂ ਤੋਂ ਲੈ ਕੇ ਬੋਲੀਵੁੱਡ ਤੱਕ ਚਰਚੇ ਨੇ ਉਹਨਾਂ ਦੇ ਹਾਂਜੀ ਹਾਂਜੀ ਇੱਦਾਂ ਹੀ ਸਿਧਾਰਥ ਮਲਹੋਤਰਾ ਅਤੇ ਵਿੱਕੀ ਕੌਸ਼ਲ ਵੀ ਸਾਡੀ ਪੰਜਾਬੀ ਇੰਡਸਟਰੀ 'ਚੋਂ ਹੀ ਨਿਕਲ ਕੇ ਗਏ ਹਨ ਹਾਂਜੀ ਅਤੇ ਮੈਂ ਸੋਚ ਰਹੀ ਸੀ ਚੱਲਦੇ ਹਾਂ ਕਿਸੇ ਦਿਨ ਇਕੱਠੇ ਹੀ ਦਿਲਜੀਤ ਦੀ ਨਵੀਂ ਮੂਵੀ ਕ੍ਰਿਊ ਵੇਖਣ ਠੀਕ ਹੈ ਜੀ ਓਕੇ